ਅੱਜ ਕੱਲ੍ਹ ਬੱਚੇ ਬਹੁਤ ਹੀ ਮੋਬੈਲ ਦੇਖਦੇ ਅਤੇ ਉਹਨਾਂ ਦੀਆਂ ਅੱਖਾਂ 'ਤੇ ਦਿਮਾਗ਼ 'ਤੇ ਅਸਰ ਪੈਂਦਾ ਏ ਅਤੇ ਉਹਨਾਂ ਦੀ ਸਿਹਤ 'ਤੇ ਵੀ ਅ ਬਹੁਤ ਜ਼ਿਆਦਾ ਅਸਰ ਪੈਂਦਾ ਏ ਇਸ ਨੂੰ ਧਿਆਨ ਰੱਖਦੇ ਹੋਏ ਬੱਚਿਆਂ ਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਬਾਹਰ ਭੇਜਣ ਅਤੇ ਉਹਨਾਂ ਦਾ ਧਿਆਨ ਰੱਖਣ ਅਤੇ ਉਹਨਾਂ ਨੂੰ ਫੋਨ ਤੋਂ ਦੂਰ ਰੱਖਣ ਉਹਨਾਂ ਨੂੰ ਖੇਡਾਂ ਵ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਦੂਜਾ ਸਕੂਲ ਵਿੱਚ ਬੱਚੇ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਅਤੇ ਉੱਥੇ ਵੀ ਟੀਚਰਾਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣ ਅਤੇ ਪੜ੍ਹਾਈ ਵੱਲ ਵੀ ਧਿਆਨ ਦੇਣ ਜਿਸ ਕਾਰਨ ਉਹਨਾਂ ਦੇ ਪੜ੍ਹਨ ਅਤੇ ਖੇਡਣ ਵਿੱਚ ਰੁਚੀ ਜ਼ਿਆਦਾ ਹੋਵੇਗੀ ਅਤੇ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਅਤੇ ਸਕੂਲਾਂ ਵਿੱਚ ਖੇਡਾਂ ਕਰਵਾਈਆਂ ਜਾਣ ਜਿਸ ਨਾਲ਼ ਬੱਚਿਆਂ ਦੀ ਰੁਚੀ ਵੀ ਵਧੇਗੀ ਅਤੇ ਉਹਨਾਂ ਨੂੰ ਖੇਡਾਂ ਵਿੱਚ ਇਹ ਬਹੁਤ ਸਾਰੇ ਇਨਾਮ ਇਵੈਂਟਸ ਔਰ ਕਈ ਤਰ੍ਹਾਂ ਦੀਆਂ ਐਸੀਆਂ ਚੀਜ਼ਾਂ ਕਰਵਾਉਣੀਆਂ ਚਾਹੀਦੀਆਂ ਹਨ ਜਿਹਦੇ ਨਾਲ਼ ਕਿ ਬੱਚੇ ਖੇਡਾਂ ਵੱਲ ਜ਼ਿਆਦਾ ਪ੍ਰਭਾਵਿਤ ਹੋਣ ਅਤੇ ਆਪਣਾ ਘੱਟ ਤੋਂ ਘੱਟ ਸਮਾਂ ਮੋਬੈਲ ਵੱਲ ਦੇਣ